ਮੋਹਾਲੀ ਜ਼ਿਲ੍ਹਾ ਮਨੋਰੰਜਨ ਦੇ ਸਾਧਨਾਂ ਨਾਲ਼ ਭਰਪੂਰ ਹੈ ਇੱਥੇ ਕਾਫ਼ੀ ਪਾਰਕ ਖੇਡ ਸਹੂਲਤਾਂ ਥੀਏਟਰ ਅਤੇ ਕਾਫ਼ੀ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਪ ਇੱਥੇ ਕਈ ਮੇਲੇ ਵੀ ਲੱਗਦੇ ਹਨ ਜਿਵੇਂ ਵਿਸਾਖੀ ਦਾ ਮੇਲਾ ਅਤੇ ਮਾਘੀ ਦਾ ਮੇਲਾ ਵੱਡੇ ਅਤੇ ਬੱਚੇ ਬੜੇ ਹੀ ਉਤਸ਼ਾਹ ਨਾਲ਼ ਮੇਲਾ ਵੇਖਣ ਜਾਂਦੇ ਹਨ ਇੱਥੇ ਕਈ ਤਰ੍ਹਾਂ ਦੇ ਬਗ਼ੀਚੇ ਵੀ ਬਣਾਏ ਹੋਏ ਹਨ ਅਤੇ ਬਗ਼ੀਚੇ ਵਿੱਚ ਕਈ ਪ੍ਰਕਾਰ ਦੇ ਫੁੱਲ ਲੱਗੇ ਹੋਏ ਹਨ ਸ਼ਾਮ ਨੂੰ ਬੱਚੇ ਅਤੇ ਬਜ਼ੁਰਗ ਦੋਨੋਂ ਬਗ਼ੀਚਿਆਂ ਵਿੱਚ ਜਾਂਦੇ ਹਨ ਅਤੇ ਬੱਚੇ ਆਪਣੇ ਦੋਸਤਾਂ ਨਾਲ਼ ਖੇਡਦੇ ਹਨ ਅਤੇ ਬਜ਼ੁਰਗ ਇਨ੍ਹਾਂ ਬਗ਼ੀਚਿਆਂ ਵਿੱਚ ਸੈਰ ਕਰਦੇ ਹਨ ਅਤੇ ਆਪਣੇ ਦੋਸਤਾਂ ਨਾਲ਼ ਗੱਲਬਾਤ ਕਰਦੇ ਹਨ